ਸਾਡੀਆਂ ਮਨਪਸੰਦ ਖੇਡਾਂ ਬਹੁਤ ਸਾਰੀਆਂ ਹਨ ਜਿਵੇਂ ਕਿ ਯੋਗਾ ਵਗੈਰਾ ਕਰਨਾ ਕ੍ਰਿਕਟ ਵਗੈਰਾ ਖੇਡਣਾ ਫੁੱਟਬਾਲ ਬੈਡਮਿੰਟਨ ਹੋਕੀ ਆਦਿ ਬਹੁਤ ਸਾਰੀਆਂ ਖੇਡਾਂ ਹਨ ਜੋ ਕੀ ਸਾਡੀਆਂ ਬਹੁਤ ਹੀ ਮਨਪਸੰਦ ਖੇਡਾਂ ਹਨ ਅਤੇ ਅਸੀਂ ਉਹਨਾਂ ਨੂੰ ਖੇਡਣ ਦੇ ਨ ਅਸੀਂ ਉਹਨਾਂ ਨੂੰ ਦੇਖਣ ਦੇ ਨਾਲ ਨਾਲ ਉਹਨਾਂ ਨੂੰ ਖੇਡਣਾ ਵੀ ਪਸੰਦ ਕਰਦੇ ਹਨ ਜਿਵੇਂ ਕੀਿ ਮੈਂ ਕ੍ਰਿਕਟ ਕਿ ਹਰ ਸ਼ਾਮ ਨੂੰ ਮੈਂ ਹਰ ਰੋਜ਼ ਆਪਣੇ ਸ਼ਾਮ ਨੂੰ ਗਲਿਆਰੇ ਵਿੱਚ ਕ੍ਰਿਕਟ ਖੇਡਦਾ ਹਾਂ ਅਤੇ ਉਸ ਤਰ੍ਹਾਂ ਮੈਂ ਹਰ ਸੰਡੇ ਨੂੰ ਦੌੜਦਾ ਵੀ ਹਾਂ ਅਤੇ ਮੈਂ ਹਰ ਸੰਡੇ ਨੂੰ ਕੰਪਨੀ ਬਾਗ਼ ਵਿੱਚ ਬ ਬਹੁਤ ਕੰਪਨੀ ਬਾਗ਼ ਵਿੱਚ ਕ੍ਰਿਕਟ ਖੇਡਣਾ ਪਸੰਦ ਕਰਦਾ ਹਾਂ ਅਤੇ ਕ੍ਰਿਕਟ ਨੂੰ ਦੇਖ ਕੇ ਕ੍ਰਿਕਟ ਕ੍ਰਿਕਟ ਖੇਡਦਾ ਵੀ ਹਾਂ ਤੇ ਇਸੇ ਤਰ੍ਹਾਂ ਉਹਨਾਂ ਇਸੇ ਤਰ੍ਹਾਂ ਸਾਡੇ ਮੁਹੱਲੇ ਵਿੱਚ ਹਰ ਸਾਲ ਕਬੱਡੀ ਕਬੱਡੀ ਵੀ ਹੁੰਦੀ ਹੈ ਅਤੇ ਇਸੇ ਤਰ੍ਹਾਂ ਹਰ ਸਾਲ ਕਬੱਡੀ ਵੀ ਹੁੰਦੀ ਹੈ ਅਤੇ ਆਪਾਂ ਕਬੱਡੀ ਖੇਡਣਾ ਵੀ ਬਹੁਤ ਪਸੰਦ ਕਰਦੇ ਹਨ ਅਤੇ ਉਸ ਦੇ ਨਾਲ ਨਾਲ ਅੱਥਾ ਐਸਥ ਐਤਕੀ ਵਾਰ ਸਾਡੇ ਵਰਡ ਕੱਪ ਵੀ ਹੋ ਹੈ ਅਤੇ ਵਰਲਡ ਕੱਪ ਅਸੀਂ ਹਾ ਬੁਰੀ ਤਰ੍ਹਾਂ ਹਾਰ ਗਏ ਹਨ ਲੇਕਿਨ ਵਲਡ ਕੱਪ ਦੇ ਸਾਨੂੰ ਹਰ ਮੈਚ ਬਹੁਤ ਵਧੀਆ ਲੱਗੇ ਹਨ ਅਤੇ ਅਸਾਂ ਹਰ ਮੈਚ ਨੂੰ ਜਿੱਤਿਆ ਵੀ ਹੈ ਲੇਕਿਨ ਕੁ ਲੇਕਿਨ ਇਸ ਵਾਰ ਆਪਾਂ ਵਲਡ ਕੱਪ ਹਾਰ ਗਏ ਹਨ ਕੋਈ ਗੱਲ ਨਹੀਂ ਲੇਕਿਨ ਆਪਾਂ ਆਈ ਪੀ ਐੱਲ ਵੀ ਹੁਣ ਚਾਲੂ ਹੋਣ ਵਾਲੇ ਹਨ ਅਤੇ ਆਪਾਂ ਇਸ ਵਾਰ ਆਈ ਪੀ ਐੱਲ ਜ਼ਰੂਰ ਜਿੱਤਾਂਗੇ ਅਤੇ ਨਾਲ ਹੀ ਕੁੜੀਆਂ ਦੇ ਵੀ ਵਲਡ ਕ ਕੁੜੀਆਂ ਦੇ ਵੀ ਵਲਡ ਕੱਪ ਹੋਏ ਸਨ ਜਿਸ ਵਾਰ ਸਾਨੂੰ ਜਿੱਤ ਹਾਸਲ ਹੋਈ ਹੈ ਅਤੇ ਇਸੇ ਤਰ੍ਹਾਂ ਹੁਣ ਆਈ ਪੀ ਐੱਲ ਵੀ ਕੁੜੀਆਂ ਦੇ ਚਾਲੂ ਹੋਏ ਹਨ ਜੋ ਕਿ ਬਹੁਤ ਹੀ ਵਧੀਆ ਹੋ ਰਹੇ ਹਨ ਅਤੇ ਹੁਣ ਆਈ ਪੀ ਐੱਲ ਮੁੰਡਿਆਂ ਦੇ ਵੀ ਚਾਲੂ ਹੋਣ ਵਾਲੇ ਹਨ ਜੋ ਕਿ ਬਹੁਤ ਵਧੀਆ ਹੋਣਗੇ ਅਤੇ ਇਸੇ ਤਰ੍ਹਾਂ ਹੁਣ ਆਹ ਟੀ ਟਵੰਟੀ ਦਾ ਵੀ ਵਲਡ ਕੱਪ ਆ ਰਿਹਾ ਹੈ ਜੋ ਕਿ ਅਸੀਂ ਦੇਖਾਂਗੇ ਅਤੇ ਇਸ ਵਾਰ ਅਸੀਂ ਜਿੱਤ ਵੀ ਪ੍ਰਾਪਤ ਕਰਾਂਗੇ ਅਤੇ ਇਸੇ ਤਰ੍ਹਾਂ ਆਪਾਂ ਕ੍ਰਿਕਟ ਨੂੰ ਬਹੁਤ ਵਧੀਆ ਖੇਡਦੇ ਰਹਾਂਗੇ ਅਤੇ ਹੁਣ ਕ੍ਰਿਕਟ ਸਾਡੀ ਗਲੀ ਵਿੱਚ ਵੀ ਹੁੰਦਾ ਹੈ ਹਰ ਰੋਜ਼ ਅਸੀਂ ਸ਼ਾਮ ਨੂੰ ਕ੍ਰਿਕਟ ਵੀ ਖੇਲਦੇ ਰਹਿੰਦੇ ਹਾਂ